ਮੇਰੇ ਕੋਲ ਪਹਿਲਾਂ ਬਟਨਾਂ ਵਾਲਾ ਫੋਨ ਸੀ ਜਿਹੜੇ ਟੱਚਪੈਡ ਫੋਨ ਜਿਹਨਾਂ ਨੂੰ ਕਿਹਾ ਜਾਂਦਾ ਹੈ ਅਤੇ ਹੁਣ ਉਹ ਬਹੁਤ ਟਾਈਮ ਬਾਅਦ ਹੁਣ ਮੇਰੇ ਕੋਲ ਸਮਾਟ ਫੋਨ ਆਇਆ ਹੈ ਅਤੇ ਮੈਂ ਇਹਨਾਂ ਦੇ ਵਿੱਚ ਤਕਨੋਲਜੀ ਨੂੰ ਵੇਖ ਕੇ ਬਹੁਤ ਹੈਰਾਨ ਹੋਈ ਹਾਂ ਕਿਉਂਕਿ ਪਹਿਲਾਂ ਸਿਰਫ ਅਸੀਂ ਇੱਕ ਫੋਨ ਤੋਂ ਫੋਨ ਕਰ ਸਕਦੇ ਸੀ ਜੋ ਪਹਿਲੇ ਬਟਨਾਂ ਵਾਲੇ ਫੋਨ ਚੱਲਦੇ ਸੀ ਟੱਚ ਟੱਚਪੈਡ ਵਾਲੇ ਫੋਨ ਚੱਲਦੇ ਸੀ ਉਹਨਾਂ ਨੂੰ ਸਿਰਫ ਅਸੀਂ ਨੰਬਰ ਹੀ ਮਿਲਾ ਕੇ ਗੱਲ ਕਰ ਸਕਦੇ ਸੀਗੇ ਪਰ ਜਿਵੇਂ ਸਮਾਰਟ ਫੋਨ ਹ ਉਹਦੇ ਉੱਤੇ ਅਸੀਂ ਫੋਨ ਕਾਲ ਦੇ ਨਾਲ ਨਾਲ ਹੋਰ ਬਥੇ ਬਹੁਤ ਬਥੇਰਾ ਕੁਝ ਕਰ ਸਕਦੇ ਹਾਂ ਜਿਵੇਂ ਕਿ ਹੁਣ ਟੈਕਨੋਲੋਜੀ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਜਿਸ ਵਿੱਚ ਅਸੀਂ ਜਿਵੇਂ ਕਿ ਹੁਣ ਸੋਸ਼ਲ ਮੀਡੀਆ ਹੋ ਗਿਆ ਕੋਈ ਮੈਸੇਜ ਹੋ ਗਏ ਕੋਈ ਮੈਸੇਜ ਦੇਣਾ ਹੋਵੇ ਮਤਲਬ ਇੱਕ ਫੋਨ ਕਾਲ ਤੋਂ ਇਲਾਵਾ ਅਸੀਂ ਹੋਰ ਬਥੇਰਾ ਕੁਝ ਕਰ ਸਕਦੇ ਹਾਂ ਸੋਸ਼ਲ ਮੀਡੀਆ ਦੇਖ ਸਕਦੇ ਹਾਂ ਇੰਟਰਨੈਟ ਦੀ ਵਰਤੋਂ ਕਰ ਸਕਦੇ ਹਾਂ ਵੱਖ ਵੱਖ ਜਿੱਥੇ ਸਾਨੂੰ ਜ਼ਰੂਰਤ ਹੋਵੇ ਜਿਵੇਂ ਕੋਈ ਵੀ ਅਸੀਂ ਕੰਮ ਕਰਨਾ ਹੋਵੇ ਇੰਟਰਨੈਟ ਦੀ ਇੰਨੀ ਵਧੇਰੇ ਅਸੀਂ ਵਰਤੋਂ ਕਰ ਸਕਦੇ ਹਾਂ ਜਿ ਜਿਸ ਦੀ ਮੁਸ਼ਕ ਕੋਈ ਵੀ ਮੁਸ਼ਕਿਲ ਹੋਵੇ ਕੁਛ ਅਸੀਂ ਵੇਖਣਾ ਹੋਵੇ ਕਿਸੇ ਚੀਜ਼ ਬਾਰੇ ਅਸੀਂ ਖੋਜਣਾ ਹੋਵੇ ਕੋਈ ਸਰਚ ਕਰਨੀ ਹੋਵੇ ਚੀਜ਼ ਅਸੀਂ ਉਸਨੂੰ ਆਰਾਮ ਦੇ ਨਾਲ ਕੋਈ ਵੀ ਸੋਸ਼ਲ ਮੀਡੀਆ ਜਿਵੇਂ ਇੰਟਰਨੈਟ ਦੇ ਉੱਤੇ ਜਿਵੇਂ ਗੂਗਲ ਦੇ ਉੱਤੇ ਅਸੀਂ ਸਰਚ ਕਰ ਸਕਦੇ ਹਾਂ ਅਸੀਂ ਖੋਜ ਸਕਦੇ ਹਾਂ ਨਵੀਆਂ ਨਵੀਆਂ ਚੀਜ਼ਾਂ ਜਿਸ ਬਾਰੇ ਹੁਣ ਸਾਨੂੰ ਹਰੇਕ ਚੀਜ਼ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਤਾਂ ਮੈਨੂੰ ਇਹ ਇੱਕ ਬਹੁਤ ਅੱਛੀ ਚੀਜ਼ ਲੱਗੀ ਕਿ ਜੇ ਕੋਈ ਵੀ ਸਾਨੂੰ ਮੁਸ਼ਕਿਲ ਹੈ ਕੋਈ ਸਾਨੂੰ ਐਜੂਕੇਸ਼ਨ ਦੇ ਵਿੱਚ ਕੋਈ ਪੜ੍ਹਾਈ ਦੇ ਵਿੱਚ ਕੋਈ ਜ਼ਰੂਰਤ ਹੈ ਜਾਂ ਕਿਸੇ ਚੀਜ਼ ਦੇ ਵਿੱਚ ਵੀ ਜ਼ਰੂਰਤ ਹੈ ਤਾਂ ਅਸੀਂ ਉਸਨੂੰ ਆਰਾਮ ਦੇ ਨਾਲ ਇੰਟਰਨੈਟ ਦੇ ਉੱਤੇ ਜਾ ਕੇ ਖੋਜ ਸਕਦੇ ਹਾਂ ਅਤੇ ਅਸੀਂ ਉਸ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਤਾਂ ਮਤਲਬ ਟੈਕਨੋਲੋਜੀ ਦਾ ਹੁਣ ਬਹੁਤ ਹੀ ਮਤਲਬ ਇੱਕ ਵਧੀਆ ਰੂਪ ਵੀ ਹੈ ਅਤੇ ਇੱਕ ਜੋ ਹੈ ਦੂਸਰਾ ਰੂਪ ਵੀ ਹੈ ਜਿਸ ਵਿੱਚ ਜਿਵੇਂ ਸੋਸ਼ਲ ਮੀਡੀਆ ਆ ਗਿਆ ਉਹਦੇ 'ਤੇ ਬਹੁਤ ਕੁਝ ਪਾਇਆ ਗਿਆ ਹੈ ਹੈ ਨਾ ਜਿਵੇਂ ਬੱਚੇ ਜੋ ਕਿ ਬੱਚਿਆਂ ਦੇ ਦਿਮਾਗਾਂ ਨੂੰ ਵਧੇਰੇ ਪ੍ਰਭਾਵ ਕਰ ਪ੍ਰਭਾਵਿਤ ਕਰਦਾ ਹੈ ਜਿਵੇਂ ਹੁਣ ਜੋ ਚੀਜ਼ ਬੱਚੇ ਨਹੀਂ ਵੇਖਣੀ ਚਾਹੀਦੀ ਉਹ ਚੀਜ਼ ਸਭ ਕੁਝ ਸੋਸ਼ਲ ਮੀਡੀਆ ਦੇ ਉੱਤੇ ਮਿਲਦੀ ਹੈ ਅਤੇ ਬੱਚੇ ਇਸ ਦੇ ਦੁਰਉਪਯੋਗ ਵੀ ਕਰਦੇ ਹਨ ਅਤੇ ਜਿਹੜੇ ਮਾਪੇ ਇਸ ਜੋ ਬੱਚਿਆਂ ਦਾ ਧਿਆਨ ਰੱਖਦੇ ਹਨ ਕਿ ਜਿਨਾਂ ਕੋਲ ਸਮਾਰਟ ਫੋਨ ਆ ਉਹਨਾਂ ਨੂੰ ਕੀ ਕਹਿੰਦੇ ਆ ਮਤਲਬ ਸੰਭਾਲ ਕੇ ਵਰਤਿਆ ਜਾਵੇ ਉਹ ਤਾਂ ਬੱਚੇ ਸਹੀ ਰਹਿੰਦੇ ਆ ਠੀਕ ਆ ਐਵੇਂ ਮਤਲਬ ਟੈਕਨੋਲੋਜੀ ਵਿੱਚ ਬਹੁਤ ਹੀ ਬਦਲਾਵ ਆਇਆ ਹੈ ਜਿਸ ਦਾ ਕੋ ਮਤਲਬ ਵਧੀਆ ਇੱਕ ਰੂਪ ਵੀ ਹੈ ਅਤੇ ਇੱਕ ਮਾੜਾ ਰੂਪ ਵੀ ਹੈ